ਅਸੀਂ ਗੁਰਦੁਆਰਾ ਸਾਹਿਬ ਪਟਿਆਲੇ ਜਾਣਾ ਸੀ ਅਤੇ ਫਿਰ ਅਸੀਂ ਕੈਬ ਬੁੱਕ ਕੀਤੀ ਪਰ ਉਸ ਕੈਬ ਦੀ ਜਿਹੜੀ ਡਰਾਈਵਿੰਗ ਸੀ ਨਾ ਉਸ ਡਰਾਈਵਰ ਦੀ ਉਹ ਕੋਈ ਜ਼ਿਆਦਾ ਭਰੋਸੇ ਯੋਗ ਨਹੀਂ ਸੀ ਕਿਉਂਕਿ ਕਦੇ ਤਾਂ ਉਹ ਓਵਰਟੇਕਿੰਗ ਕਰ ਰਿਹਾ ਸੀ ਕਦੇ ਕਾਫੀ ਸਪੀਡ ਵੀ ਜਾ ਰਿਹਾ ਸੀ ਕਦੇ ਹੌਲੀ ਹੌਲੀ ਕਰ ਲੈਂਦਾ ਸੀਗਾ ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਫਿਰ ਅਸੀਂ ਕਿਤੇ ਦੁਬਾਰਾ ਫਿਰ ਕਿਤੇ ਸਥਾਨਕ ਯਾਤਰਾ 'ਤੇ ਜਾਈਏ ਅਤੇ ਮੈਂ ਤੁਹਾਡੀ ਸਲਾਹ ਲੈਣਾ ਚਾਹੁੰਦੀ ਹਾਂ ਕਿ ਹੁਣ ਮੈਂ ਕਿਹੜੀ ਕੈਬ ਕਰਾਂ ਜਾਂ ਕਿਸੇ ਕਿਸੇ ਬੱਸ ਦੀ ਮਤਲਬ ਕਿਹਦੀ ਸਰਵਿਸ ਲਵਾਂ ਤਾਂ ਕਿ ਅਸੀ ਆਰਾਮ ਨਾਲ ਉੱਥੇ ਪਹੁੰਚ ਜਇਉ ਕਿਉਂਕਿ ਜਿਹੜਾ ਮੇਰਾ ਪਿਛਲਾ ਐਕਸਪੀਰਐਂਸ ਔਰ ਮੇਰਾ ਕੋਈ ਅੱਛ ਵਧੀਆ ਜ਼ਿਆਦਾ ਭਰੋਸੇਯੋਗ ਨਹੀਂ ਹੈ ਕਿਉਂਕਿ ਅਸੀਂ ਤਾਂ ਮਤਲਬ ਜ਼ਿਆਦਾ ਆਨੰਦ ਕੀ ਮਾ ਆਨੰਦ ਕੀ ਮਤਲਬ ਮਾਨਣਾ ਸੀਗਾ ਅਤੇ ਸਾਨੂੰ ਤਾਂ ਵੈਸੇ ਡਰ ਡਰ ਕੇ ਨਾ ਅਸੀਂ ਉਹਦੇ ਵਿੱਚ ਬੈਠੇ ਰਹੇ ਕਿ ਪਤਾ ਨਹੀਂ ਕਿੱਥੇ ਜਾ ਕੇ ਸਾਡਾ ਠਾਹ ਕਰ ਦੇਣੀ ਹੈ ਇਹਨੇ ਜਾਂ ਇਹਨੇ ਸਾਨੂੰ ਕਿਤੇ ਨਾ ਕਿਤੇ ਇਹਨੇ ਪੰਗੇ ਸਾਡੇ ਪਾ ਦੇਣਾ ਅਤੇ ਅਸੀਂ ਫਿਰ ਉੱਥੇ ਪਹੁੰਚਣਾ ਵੀ ਹੈ ਕਿ ਨਹੀਂ ਪਹੁੰਚਣਾ ਪਰ ਪਰਮਾਤਮਾ ਦਾ ਸ਼ੁਕਰ ਹੈ ਬਾਬਾ ਜੀ ਦਾ ਕਿ ਅਸੀਂ ਠੀਕ ਠਾਕ ਉੱਥੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ